ਸਤਿ ਸ਼੍ਰੀ ਅਕਾਲ ਮੈਂ ਪਠਾਨਕੋਟ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਭੋਏ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਹੈਗਾਂ ਅਤੇ ਮੈਂ ਜਿਵੇਂ ਗੱਲ ਗੱਲ ਕਰਾਂ ਕਿ ਇਹ ਬੱਚੇ ਮਨੋਰੰਜਨ ਲਈ ਮ ਅ ਬੱਚੇ ਖਾਲੀ ਸਮੇਂ ਵਿੱਚ ਮਨੋਰੰਜਨ ਕਿਵੇਂ ਕਰਦੇ ਹੈ ਅਤੇ ਇਹ ਬੱਚੇ ਜਿਵੇਂ ਵੀ ਸਾਡੇ ਗਰਾਊਂ ਸਾਡੇ ਜਿਹੜੇ ਪਿੰਡ ਵਿੱਚ ਸਰਪੰਚ ਨੇ ਪਾਰਕ ਬਣਾਏ ਹੋਏ ਹਨ ਅਤੇ ਜਦੋਂ ਵੀ ਬੱਚੇ ਖਾਲੀ ਸਮੇਂ ਵਿੱਚ ਜਾਂ ਖਾਲੀ ਹੁੰਦੇ ਹਨ ਜਿੱਦਾਂ ਖਾਲੀ ਸਮੇਂ ਵਿੱਚ ਖੇਡਾਂ ਖੇਡਦੇ ਹਨ ਜਿਵੇਂ ਕਿ ਕੋਈ ਕ੍ਰਿਕਟ ਖੇਡਦਾ ਹੈ ਕੋਈ ਵਾਲੀਬਾਲ ਜਾਂ ਕੋਈ ਫੁੱਟਬਾਲ ਜਾਂ ਹੋਰ ਗੇਮਾਂ ਜਿਵੇਂ ਕਿ ਸਾਡੇ ਸਰਪੰਚ ਨੇ ਇੱਥੇ ਸਾਡੇ ਪਿੰਡ ਝੂਲੇ ਵੀ ਲਾਏ ਸਨ ਕਿ ਕੋਈ ਬੱਚੇ ਝੂਲੇ ਖੇਡਦੇ ਹਨ ਅਤੇ ਝੂਲੇ ਲੈ ਲੈਂਦੇ ਹੈ ਅਤੇ ਕੁਝ ਬੱਚੇ ਉੱਥੇ ਬਾਂਦਰ ਕਿੱਲਾ ਖੇਡਦੇ ਹਨ ਤਾਂ ਬਾਂਦਰ ਕਿੱਲਾ ਖੇਡਦੇ ਹਨ ਅਤੇ ਕੋਈ ਬੱਚੇ ਛੂ ਛਮਿਟੀ ਖੇਡਦੇ ਹਨ ਕੋਈ ਆਪਣੀਆਂ ਹੀ ਨਿਆਣੇ ਆਪਣੀਆਂ ਛੋਟੀਆਂ ਮੋਟੀਆਂ ਗੇਮਾਂ ਖੇਡਦੇ ਹਨ ਅਤੇ ਤਾਂ ਕਰਕੇ ਇਹ ਬੱਚੇ ਉੱਥੇ ਜਿਹੜੇ ਸਾਡੇ ਗਰਾਊਂਡ ਵਿੱਚ ਹੈਗੇ ਹੈ ਇਹ ਕੁਝ ਬੱਚੇ ਬਾਹਰੋਂ ਮੈਚ ਲਾਉਣ ਵੀ ਆਉਂਦੇ ਹੈਗੇ ਹੈ ਅਤੇ ਕਈ ਬੱਚੇ ਹੋਰ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ ਅਤੇ ਜਿਹੜੀਆਂ ਬੱਚਿਆਂ ਨੂੰ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਜਿਵੇਂ ਕਿ ਉਹ ਤੰਦਰੁਸਤ ਰਹਿੰਦੇ ਹਨ ਅੱਜ ਕੱਲ ਜਿਹੜੇ ਬੱਚੇ ਹੈਗੇ ਹੈ ਇਸ ਜਲਦ ਬਿਮਾਰ ਹੋ ਜਾਂਦੇ ਹੈ ਕਿਉਂ ਬਿਮਾਰ ਹੋ ਜਾਂਦੇ ਕਿਉਂਕਿ ਉਹ ਖੇਡਾਂ ਨਹੀਂ ਖੇਡਦੇ ਹੈਗੇ ਜੇ ਖੇਡਾਂ ਨਹੀਂ ਖੇਡਣ ਬੱਚ ਬੱਚੇ ਤਾਂ ਉਹ ਤੰਦਰੁਸਤ ਨਹੀਂ ਰਹਿੰਦੇ ਜਲਦੀ ਬਿਮਾਰ ਹੋ ਜਾਂਦੇ ਹੈ ਅਤੇ ਜੇ ਜਲਦੀ ਬਿਮਾਰ ਹੋ ਜਾਣਗੇ ਫਿਰ ਉਸਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਕਰਕੇ ਫਿਰ ਉਹ ਠੀਕ ਨਹੀਂ ਰਹਿੰਦੇ ਉਨ੍ਹਾਂ ਦੀ ਸਿਹਤ ਅਤੇ ਜੇ ਕੁ ਜੇ ਬੱਚੇ ਖੇਡਣ ਖੇਡਦੇ ਰਹਿਣ ਅਤੇ ਉਹ ਆਪਣੇ ਉੱਦਾਂ ਹੀ ਉਹ ਤੰਦਰੁਸਤ ਰਹਿੰਦੇ ਹੈ ਤੰਦਰੁਸਤ ਰਹਿਣ ਨਾਲ ਦੀ ਬੱਚੇ ਦੀ ਇਮਊਨਟੀ ਵੱਧਦੀ ਹੈ ਅਤੇ ਤਾਂ ਕਿ ਬੱਚਿਆਂ ਨੂੰ ਖੇਡਦੇ ਰਹਿਣਾ ਚਾਹੀਦਾ ਹੈ ਜੀ ਕ ਤਾਂ ਫਰੀ ਖਾਲੀ ਟਾਇਮ ਵਿੱਚ ਖੇਡਣਾ ਚਾਹੀਦਾ ਹੈ ਜੀ ਜਾਂ ਅੱਜ ਕੱਲ ਕਈ ਬੱਚੇ ਖਾਲੀ ਸਮੇਂ ਵਿੱਚ ਪਰਚੀਆਂ ਖੇਡਦੇ ਹਨ ਪਰਚੀਆਂ ਖੇਡ ਕੇ ਆਪਣਾ ਮਨੋਰੰਜਨ ਕਰਦੇ ਹਨ ਆਪਣੇ ਖਾਲੀ ਟੈਮ ਨੂੰ ਉਹ ਖੁਸ਼ਹਾਲੀ ਭਰਦੇ ਹਨ ਅਤੇ ਬਸ ਕੁਝ ਇਸ ਇਹੀ ਗੱਲਾਂ ਹੈਗੀਆਂ ਜੋ ਬੱਚੇ ਕਰਦੇ ਹਨ ਧੰਨਵਾਦ